ਹਾਂ ਮੈਂ ਚਾਟ ਪੇਪਰ ਉੱਤੇ ਹੀ ਪੇਂਟ ਕਰਨਾ ਜਾਣਦਾ ਹਾਂ ਮੈਂ ਉਸ ਨੂੰ ਹੀ ਵਧੀਆ ਤਰੀਕੇ ਨਾਲ ਕਰ ਸਕਦਾ ਹਾਂ ਵੈਸੇ ਮੈਂ ਕੈਨਵਸ ਵਾਟਰ ਕਲਰ ਵੀ ਨਾਲ ਨਾਲ ਸਿੱਖ ਰਿਹਾ ਹਾਂ ਪਰ ਜ਼ਿਆਦਾਤਰ ਮੇਰਾ ਚਾਟ ਪੇਪਰ 'ਤੇ ਹੀ ਮੈਂ ਪੇਂਟ ਕਰਦਾ